ਮੈਨੂੰ ਕੁਦਰਤੀ ਨਜ਼ਾਰਿਆਂ ਦੀਆਂ ਤਸਵੀਰਾਂ ਲੈਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਅਤੇ ਇਸ ਲਈ ਮੈਂ ਚੰਡੀਗੜ੍ਹ ਛੱਤਬੀੜ ਜ਼ੂ ਗਿਆ ਇਸ ਵਿੱਚ ਮੈਂ ਬਹੁਤ ਸਾਰੇ ਜਾਨਵਰਾਂ ਦੀਆਂ ਤਸਵੀਰਾਂ ਲਈਆਂ ਜਿਵੇਂ ਕਿ ਟਾਈਗਰ ਸ਼ੇਰ ਚੀਤਾ ਲੱਕੜ ਬੱਗਾ ਬਾਂਦਰ ਆਦਿ ਦੀਆਂ ਤਸਵੀਰਾਂ ਖਿੱਚੀਆਂ ਅਤੇ ਉਸ ਜ਼ੂ ਵਿੱਚ ਜਾਨਵਰਾਂ ਦੇ ਨਾਲ਼ ਨਾਲ਼ ਕਈ ਤਰ੍ਹਾਂ ਦੇ ਪੱਕਛੀ ਤੇ ਹੋਰ ਵੀ ਜੀਵ ਸਨ ਜਿਨ੍ਹਾਂ ਦੀਆਂ ਤਸਵੀਰਾਂ ਮੈਂ ਖਿੱਚੀਆਂ ਜਿਵੇਂ ਕਿ ਬਗਲੇ ਮੋਰ ਆਦਿ ਸਨ ਉੱਥੇ ਝੀਲ ਵੀ ਸੀ ਜਿਸ ਵਿੱਚ ਮਗਰਮੱਛ ਆਦਿ ਰਹਿੰਦੇ ਸੀ ਅਤੇ ਉਸ ਵਿੱਚ ਹਿਪੋ ਵਗੈਰਾ ਵੀ ਸੀ ਇਸ ਦੀਆਂ ਮੈਂ ਤਸਵੀਰਾਂ ਖਿੱਚੀਆਂ ਅਤੇ ਜ਼ੂ ਦੇ ਬਾਅਦ ਮੈਂ ਬਰਡ ਸੈਂਚਰੀ ਗਿਆ ਅਤੇ ਉੱਥੇ ਅਲੱਗ ਅਲੱਗ ਤਰ੍ਹਾਂ ਦੇ ਅਤੇ ਨਵੀਂ ਨਵੀਂ ਕਿਸਮ ਦੇ ਪੱਕਛੀਆਂ ਦੀਆਂ ਮੈਂ ਤਸਵੀਰਾਂ ਖਿੱਚੀਆਂ ਅਤੇ ਇਹਨਾਂ ਤੋਂ ਇਲਾਵਾ ਮੈਨੂੰ ਕੁਦਰਤੀ ਨਜ਼ਾਰੇ ਜਿਵੇਂ ਪਹਾੜਾਂ 'ਤੇ ਜਾਣਾ ਅਤੇ ਉੱਥੇ ਦੀਆਂ ਤਸਵੀਰਾਂ ਖਿੱਚਣਾ ਆਦਿ ਬਹੁਤ ਪਸੰਦ ਹੈ ਧੰਨਵਾਦ